ਹੈਲੋ ਹਾਂਜੀ ਨਮਸਕਾਰ ਸਰ ਜੀ ਸਰ ਤੁਸੀਂ ਪਠਾਨਕੋਟ ਦੇ ਪਹਿਲੇ ਵਸਨੀਕ ਹੋ ਨਾ ਹਾਂਜੀ ਸਰ ਮੈਂ ਨਾ ਇੱਥੇ ਪਠਾਨਕੋਟ 'ਚ ਨਾ ਰੂਮ ਰੈਂਟ 'ਤੇ ਲਿਆ ਅਤੇ ਦਰਅਸਲ ਇੱਥੇ ਸਪਲਾਈ ਹੈ ਨਹੀਂ ਸੀ ਵਾਟਰ ਦੀ ਅਤੇ ਉਹਨਾਂ ਨੇ ਕਿਹਾ ਕਿ ਰੂਮ ਰੈਂਟ ਵਾਲੇ ਨੇ ਕਿਹਾ ਮੈਨੂੰ ਕਿ ਆਪਣੀ ਸਪਲਾਈ ਆਪ ਹੀ ਲਵਾ ਲਿਓ ਤੁਸੀਂ ਅਤੇ ਥੋੜ੍ਹਾ ਜਿਹਾ ਪ੍ਰੋਸੈਸ ਸਮਝਾ ਦਿਓਗੇ ਮੈਨੂੰ ਕਿ ਕਿੱਦਾਂ ਕਿੱਦਾਂ ਇੱਥੇ ਲੋਕਲ ਕਿਹਦੇ ਕੋਲੋਂ ਮੈਂ ਕਿਹਾ ਪਰਮਿਸ਼ਨ ਵਗੈਰਾ ਲੈਣੇ ਪੈਂਦੀ ਜਾਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਅੱਛਾ ਜੀ

ਠੀਕ ਆ ਹਾਂਜੀ ਹਾਂਜੀ ਠੀਕ ਹੈ ਜੀ

ਠੀਕ ਹੈ ਜੀ ਅਤੇ ਆਹ ਨਾ ਕ ਕਮੇਟੀ ਘਰ ਹੀ ਜਾਣਾ ਪੈਣਾ ਫਿਰ ਹੈ ਨਾ ਠੀਕ ਹੈ ਠੀਕ ਹੈ ਜੀ ਹੈ ਨਹੀਂ ਗੁਪਤਾ ਫੋਟੋ ਸਟੇਟ ਗਾਂਧੀ ਚੌਂਕ ਲਾਗੇ ਜਿਹੜਾ ਹੈ ਨਾ ਠੀਕ ਠੀਕ ਠੀਕ ਹੈ ਜੀ ਠੀਕ ਠੀਕ ਹੈ ਥੈਂਕ ਯੂ ਜੀ ਥੈਂਕ ਯੂ